ਵੈਸੇ ਤਾਂ ਸਾਡੇ ਦੇਸ਼ ਵਿੱਚ ਕਾਫੀ ਟਰਾਫੀਆਂ ਮੈਡਲ ਆਦਿ ਗੇਮਾਂ ਦੇ ਤੌਰ 'ਤੇ ਚੱਲਦੇ ਹਨ ਇਹਨਾਂ ਵਿੱਚੋਂ ਇੱਕ ਰਣਜੀਤ ਰਣਜੀ ਟਰਾਫੀ ਜਿਸ ਨੂੰ ਕਿਹਾ ਜਾਂਦਾ ਹੈ ਮਹੱਤਵਪੂਰਨ ਹੈ ਜਿਸ ਵਿੱਚ ਵੱਖ ਵੱਖ ਸੂਬਿਆਂ ਦੇ ਦੀਆਂ ਟੀਮਾਂ ਕ੍ਰਿਕਟ ਟੀਮਾਂ ਭਾਗ ਲੈਂਦੀਆਂ ਹਨ ਅਤੇ ਉਹ ਇਕੱਠੀਆਂ ਹੋ ਕੇ ਰਣਜੀ ਟਰਾਫੀ ਦੇ ਨਾਂ 'ਤੇ ਮੈਚ ਖੇਡਦੀਆਂ ਹਨ ਅਤੇ ਵੱਖ ਵੱਖ ਪੜਾਵਾਂ ਨੂੰ ਪਾਰ ਕਰਦਿਆ ਹੋਇਆ ਫਾਈਨਲ ਵਿੱਚ ਦੋ ਟੀਮਾਂ ਹੀ ਜਾਂਦੀਆਂ ਹਨ ਜਿਹਨਾਂ ਵਿੱਚੋਂ ਫਸਟ ਅਤੇ ਦੋ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਹੀ ਟਰਾਫੀਆਂ ਦੇ ਦੇਣ ਲਈ ਚੁਣੀਆਂ ਜਾਂਦੀਆਂ ਹਨ